ਸਿਹਤ ਦੇਖ ਰੇਖ ਅਤੇ ਸਮਾਜਿਕ ਸਹਾਇਤਾ ਅਤੇ ਸਨਮਾਨ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਬਜ਼ੁਰਗ ਆਬਾਦੀ ਦਾ ਸਾਹਮਣਾ ਕਰਨ ਵਾਲੀਆਂ ਮਨੁੱਖ ਮੁੱਖ ਚੁਣੌਤੀਆਂ ਇਹ ਹਨ ਕਿ ਇੱਥੇ ਬਹੁਤ ਸਾਰੀਆਂ ਉਤਰਾਅ ਚੜ੍ਹਾਅ ਵਾਲੀਆਂ ਥਾਵਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਉੱਤੇ ਚੱਲਣਾ ਇੱਕ ਆਮ ਆਦਮੀ ਜਾਂ ਇੱਕ ਬਜ਼ੁਰਗ ਲਈ ਬਹੁਤ ਔਖਾ ਹੈ ਇੱਥੋਂ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਿਖੇ ਸ਼ੁਰੂ ਤੋਂ ਹੀ ਪੌੜੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਚੜ੍ਹਨਾ ਇੱਕ ਬਜ਼ੁਰਗ ਲਈ ਬਹੁਤ ਔਖਾ ਹੈ ਇੱਥੇ ਬੁਢਾਪਾ ਪੈਨਸ਼ਨਾਂ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਦੇਖਣ ਨੂੰ ਮਿਲਦੀਆਂ ਹਨ ਇੱਥੋਂ ਦੇ ਸਰਕਾਰੀ ਹਸਪਤਾਲ ਵਿਖੇ ਵੱਡੇ ਟੈਸਟਾਂ ਜਿਵੇਂ ਕਿ ਐੱਮ ਆਰ ਆਈ ਅਤੇ ਅਲਟਰਾਸਾਊਂਡ ਦੀਆਂ ਮਸ਼ੀਨਾਂ ਉਪਲਬਧ ਨਹੀਂ ਹਨ ਰਾਸ਼ਨ ਦੇ ਡਿੱਪੂਆਂ 'ਤੇ ਰਾਸ਼ਨ ਦੀ ਯੋਗ ਸਪਲਾਈ ਵੀ ਵੇਖਣ ਨੂੰ ਨਹੀਂ ਮਿਲਦੀ ਇੱਥੇ ਪਾਣੀ ਦੀ ਸਪਲਾਈ ਵਿੱਚ ਲਗਾਤਾਰ ਰੁਕਾਵਟਾਂ ਦੇਖਣ ਨੂੰ ਮਿਲਦੀਆਂ ਹਨ ਜਿਸ ਦਾ ਆਮ ਜਨ ਜੀਵਨ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਇੱਥੋਂ ਦੇ ਬਜ਼ੁਰਗਾਂ ਦੀ ਇੱਕ ਵੱਡੀ ਸਮੱਸਿਆ ਧਾਰਮਿਕ ਸਥਾਨਾਂ ਵਿਖੇ ਪੌੜੀਆਂ ਦਾ ਹੋਣਾ ਹੈ ਇੱਥੋਂ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗ੍ਰੰਥ ਸਾਹਿਬ ਜੀ ਨੂੰ ਉੱਪਰ ਬਿਰਾਜਮਾਨ ਕੀਤਾ ਗਿਆ ਹੈ ਜਿਨ੍ਹਾਂ ਦੇ ਦਰਸ਼ਨ ਦੀਦਾਰਿਆਂ ਲਈ ਇੱਕ ਬਜ਼ੁਰਗ ਨੂੰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ ਜੋ ਕਿ ਇੱਕ ਚੁਣੌਤੀ ਦੇ ਰੂਪ ਵਿੱਚ ਸਵੀਕਾਰਿਆ ਗਿਆ ਹੈ